ਅੱਜ ਕੱਲ੍ਹ ਦੀ ਜਿਸ ਤਰ੍ਹਾਂ ਟੈਕਨੋਲਜੀ ਬਜ਼ੁਰਗ ਵਰਤਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਬਜ਼ੁਰਗਾਂ ਨੇ ਆਪਣੇ ਹਿਸਾਬ ਦੇ ਨਾਲ ਕੰਮ ਕਰ ਦਿੱਤਾ ਜਿਵੇਂ ਉਹ ਆਪਣੇ ਔਫਿਸ ਵਰਕ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਕੀਤਾ ਪਰ ਹੁਣ ਜਿਸ ਤਰ੍ਹਾਂ ਕੰਪਿਊਟਰ 'ਤੇ ਡਾਟਾ ਚੜ੍ਹਾਉਣਾ ਬੈਂਕਾਂ ਵਿੱਚ ਜਿਵੇਂ ਬਜ਼ੁਰਗ ਕੰਮ ਕਰਦੇ ਨੇ ਉਹ ਉਹਨਾਂ ਨੂੰ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ ਕਿਉਂਕਿ ਟੈਕਨੋਲੌਜੀ ਦੇ ਹਿਸਾਬ ਨਾਲ ਉਹ ਨਵਾਂ ਕੰਮ ਹੋ ਗਿਆ ਅਤੇ ਉਹਨਾਂ ਨੂੰ ਉਸ ਹਿਸਾਬ ਨਾਲ ਉਹ ਗ੍ਰੋਅ ਨਹੀਂ ਕਰ ਪਾਉਂਦੇ ਅਤੇ ਅਗਰ ਹੁਣ ਅਸੀਂ ਗੱਲ ਕਰੀਏ ਉਹ ਸੋਚਦੇ ਨੇ ਕਿ ਵੀ ਇਹਨਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਉਹ ਕੰਮ ਕਰਦੇ ਸੀ ਉਹ ਉਹਨਾਂ ਲਈ ਵਧੀਆ ਸੀ ਸੌਖਾ ਸੀ ਕਿਉਂਕਿ ਉਹਨਾਂ ਨੂੰ ਇਹ ਕੰਮ ਸਿੱਖਣਾ ਪੈਂ ਪੈ ਰਿਹਾ ਅਤੇ ਉਹਨਾਂ ਨੂੰ ਇਹਦੇ ਵਿੱਚ ਥੋੜ੍ਹੀ ਨੈਗੇਟੀ ਨੈਗਵਿਗ ਨੈਗਟੀਵਿਟੀ ਵੀ ਲੱਗਦੀ ਹੈ ਜਿਹਦੇ ਨਾਲ ਉਹ ਕਹਿੰਦੇ ਨੇ ਕਿ ਵੀ ਸੋਸ਼ਲ ਮੀਡੀਆ ਸਾਡੇ ਲਈ ਵਧੀਆ ਨਹੀਂ ਹੈ ਅਤੇ ਅਗਰ ਹੁਣ ਹੋਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਡਰ ਵੀ ਲੱਗਦਾ ਅਤੇ ਅਨਸੇਫ ਵੀ ਲੱਗਦਾ ਉਹਨਾਂ ਨੂੰ ਲੱਗਦਾ ਕਿ ਅਗਰ ਅਸੀਂ ਇਹ ਵਰਤਾਂਗੇ ਤਾਂ ਸਾਡਾ ਕੁਛ ਪਰਸਨਲ ਚੀਜ਼ ਬਾਹਰ ਵੀ ਜਾ ਸਕਦੀ ਹੈ ਸਾਡੇ ਅਕਾਊਂਟ ਹੈਕ ਵੀ ਹੋ ਸਕਦੇ ਨੇ ਅਗਰ ਅਸੀਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਾ ਵਰਤਿਆ ਤਾਂ ਧੰਨਵਾਦ